ਛੱਬੀ ਜਨਵਰੀ ਉੱਨੀ ਸੌ ਪੰਜਾਹ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਸੋਲਾਂ ਨਵੰਬਰ ਉੱਨੀ ਸੌ ਅਠਾਸੀ ਗਿਆਰਾਂ ਫਰਵਰੀ ਉੱਨੀ ਸੌ ਅੱਸੀ ਬਾਰਾਂ ਮਾਰਚ ਦੋ ਹਜ਼ਾਰ ਵੀਹ